ਹੈਲੋ ਬਰੱਦਰ ਮੈਂ ਤੁਹਾਡੀ ਕੈਬ ਬੁੱਕ ਕੀਤੀ ਸੀ ਰਾਤ ਨੂੰ ਦੋ ਵਜੇ ਜਿਸ ਨੇ ਕਿ ਮੈਨੂੰ ਮੇਰੇ ਘਰ ਵਿੱਚ ਸਹੀ ਸਲਾਮਤ ਪਹੁੰਚਾ ਦਿੱਤਾ ਸੀ ਇਸ ਲਈ ਮੈਂ ਤੁਹਾਡਾ ਬਹੁਤ ਹੀ ਧੰਨਵਾਦ ਕਰਨਾ ਚਾਹੁੰਦੀ ਹਾਂ ਕਿਉਂਕਿ ਅੱਜ ਅੱਜ ਦਾ ਇਹ ਜ਼ਮਾਨਾ ਚੱਲ ਰਿਹਾ ਹੈ ਕਿ ਰਾ ਅੱਧੀ ਰਾਤ ਨੂੰ ਘਰ ਸੁਰੱਖਿਅਤ ਪਹੁੰਚਣਾ ਬਹੁਤ ਹੀ ਮੁਸ਼ਕਲ ਹੈ ਪਰ ਤੁਹਾਡੀ ਕੈਬ ਨੇ ਮੈਨੂੰ ਮਤਲਬ ਕਿ ਤੁਸੀਂ ਮੈਨੂੰ ਸਹੀ ਸਲਾਮਤ ਘਰ ਪਹੁੰਚਾਇਆ ਹੈ ਜਿਸ ਕਰਕੇ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ